ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਪਿੰਡ ਵਿੱਚ ਇੱਕ ਇਸ ਤਰ੍ਹਾਂ ਦਾ ਘਰ ਬਣਾਉਣ ਦੀ ਸੋਚ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਉਸ ਮਕਾਨ ਦੇ ਵਾਸਤੇ ਜੋ ਮੇਰਾ ਜੋ ਜਗ੍ਹਾ ਹੋਵੇਗੀ ਉਹ ਪ੍ਰੋਪਰ ਇੱਕ ਜੋ ਹੈ ਆਪਣੇ ਪੂਰੀ ਚੋਰਸ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਕੀ ਹੈ ਮਕਾਨ ਦੀ ਪ੍ਰੋਪਰ ਜਿਹੜੀ ਹੈ ਇੱਕ ਤਰ੍ਹਾਂ ਦੀ ਬਣਾਈ ਵਧੀਆ ਹੋ ਜੇ ਅਤੇ ਆਸ ਪਾਸ ਜੋ ਮਕਾਨਾਂ ਤੋਂ ਥੋੜ੍ਹਾ ਜਿਹਾ ਹੈਗਾ ਜਿਹੜਾ ਇਮਾਰਤ ਥੋੜ੍ਹੀ ਜਿਹੀ ਉੱਚੀ ਹੋਣੀ ਚਾਹੀਦੀ ਹੈ ਅਤੇ ਇਸ ਮਕਾਨ ਦੇ ਮੇਰੇ ਨਜ਼ਦੀਕ ਮੈਨੂੰ ਵਧੀਆ ਇੱਕ ਮਾਰਕੀਟ ਵੀ ਹੋਣੀ ਚਾਹੀਦੀ ਆ ਜਿੱਥੋਂ ਮੈਂ ਕੀ ਆ ਪ੍ਰੋਪਰ ਜਾਵਾਂ ਅਤੇ ਜੋ ਮੈਨੂੰ ਲੋੜੀਂਦੀ ਸਮਾਨ ਦੀ ਲੋੜ ਹੋਵੇ ਮੈਂ ਉੱਥੋਂ ਆਪਣਾ ਸਮਾਨ ਲੈ ਆਵਾਂ ਅਤੇ ਨਾਲ ਹੀ ਮੇਰੇ ਇਸ ਮਕਾਨ ਦੇ ਨਜ਼ਦੀਕ ਮੈਨੂੰ ਇੱਕ ਰੋਡ ਵੀ ਚਾਹੀਦੀ ਹੈ ਜਿਸ ਨਾਲ ਮੈਂ ਪ੍ਰੋਪਰ ਕੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਲਦੀ ਜਾ ਸਕਾਂ ਮੈਨੂੰ ਆਉਣ ਜਾਣ ਵਿੱਚ ਕੋਈ ਬਹੁਤੀ ਜਿਹੜੀ ਹੈਗੀ ਆ ਕਠਿਨਾਈ ਨਾ ਆਵੇ ਨਾਲ ਹੀ ਮੈਂ ਇਸ ਜਗ੍ਹਾ ਦੇ ਨਜ਼ਦੀਕ ਮੈਨੂੰ ਜੋ ਹੈ ਮੈਂ ਗੁਰੂ ਘਰ ਦੇ ਨਾਲ ਮੇਰੀ ਹੈਗੀ ਹੈ ਧਾਰਮਿਕ ਜਿਹੜੀ ਹੈਗੀ ਬਿਰਤੀ ਜੁੜੀ ਹੋਈ ਹੈ ਮੈਂ ਚਾਹੁੰਦਾ ਹਾਂ ਕਿ ਮੇਰਾ ਘਰ ਮੇਰਾ ਜੋ ਮਕਾਨ ਦਾ ਜਗ੍ਹਾ ਹੈ ਇੱਥੇ ਹੋਵੇ ਜਿੱਥੇ ਕੀ ਹੈ ਮੇਰੇ ਘਰ ਦੇ ਨਜ਼ਦੀਕ ਕੋਈ ਗੁਰੂ ਘਰ ਹੋਵੇ ਜਿੱਥੇ ਮੈਂ ਕੀ ਆ ਪਾਰਟ ਟਾਈਮ ਆਪਦਾ ਜੋ ਜਾ ਕੇ ਹੈ ਉੱਥੇ ਦੋ ਮਿੰਟ ਬੈਠ ਕੇ ਚਾਰ ਮਿੰਟ ਬਹਿ ਕੇ ਆਪਦਾ ਭਜਨ ਕਰ ਸਕਾਂ ਅਤੇ ਨਾਲ ਹੀ ਮੈਂ ਜੋ ਮੈਂ ਇਸ ਤਰ੍ਹਾਂ ਸੋਚਦਾ ਹਾਂ ਕਿ ਮੈਨੂੰ ਇਹ ਘਰ ਬਣਾਉਣ ਦੇ ਵਾਸਤੇ ਜੋ ਹੈ ਮਾਰਕੀਟ ਵਿੱਚ ਚੰਗਾ ਜੋ ਹੈ ਸਰੀਆ ਬਜਰੀ ਸੀਮੈਂਟ ਵੀ ਮੈਨੂੰ ਹੈਗਾ ਚੰਗਾ ਜੋ ਹੈਗਾ ਮਿਲ ਸਕੇ ਮੈਨੂੰ ਅਗਲੀ ਗੱਲ ਮੈਂ ਤੁਹਾਡੇ ਸਾਹਮਣੇ ਇਹ ਰੱਖਣੀ ਚਾਹੁੰਦਾ ਹਾਂ ਕਿ ਅੱਜ ਕੱਲ੍ਹ ਜੋ ਹੈਗੇ ਆ ਪਿੰਡਾਂ ਵਿੱਚ ਘਰ ਦੇਖੇ ਜਾ ਰਹੇ ਨੇ ਉਹ ਪ੍ਰੋਪਰ ਕੀ ਹੈ ਪਿੰਡਾਂ ਵਿੱਚੋਂ ਪਿੱਛੇ ਚਾਰ ਮਕਾਨ ਅੱਗੇ ਬਰਾਂਡਾ ਆਮ ਤੌਰ 'ਤੇ ਇੱਕ ਸਾਈਡ 'ਤੇ ਪੌੜੀਆਂ ਚੜ੍ਹਦੀਆਂ ਇਸ ਤਰ੍ਹਾਂ ਵੇਖੇ ਜਾ ਰਹੇ ਹਨ ਅਤੇ ਹੁਣ ਇੱਦਾਂ ਜਿਹੜਾ ਹੈਗਾ ਇਹਦੇ ਵਿੱਚ ਜੋ ਹੈਗਾ ਚੇਂਜ ਆਇਆ ਹੈਗਾ ਹੁਣ ਲੋਕ ਕੀ ਕਰ ਰਹੇ ਨੇ ਕਿ ਹੁਣ ਲੋਕ ਇੱਕ ਤਰ੍ਹਾਂ ਦੀ ਕੋਠੀ ਟਾਈਪ ਬਣਾ ਰਹੇ ਨੇ ਛੋਟੇ ਮਕਾਨ ਦੇ ਵਿੱਚ ਹੀ ਜੋ ਹੈ ਲੋਕ ਦੋ ਮੰਜ਼ਲੀ ਤਿੰਨ ਮੰਜ਼ਲੀ ਜੋ ਹੈ ਬਣਾ ਕੇ ਮਕਾਨ ਨੂੰ ਉਹਦੀ ਸੁ ਸੁੰਦਰਤਾ ਨੂੰ ਜਿਹੜੇ ਹੈਗੇ ਨੇ ਉਹ ਵਧਾ ਰਹੇ ਨੇ ਇਸ ਲਈ ਅੱਜ ਕੱਲ੍ਹ ਇਹ ਜਿਹੜੇ ਹੈਗੇ ਨੇ ਚੇਂਜਿਜ਼ ਦੇਖੇ ਜਾ ਰਹੇ ਨੇ ਜਿਵੇਂ ਕਿ ਪੁਰਾਣੇ ਘਰ ਸੀਗੇ ਕੰਧਾਂ ਕੱਚੀਆਂ ਸਨ ਸਾਈਡ 'ਤੇ ਕੰਧਾਂ ਪਲੱਸਤਰ ਵੀ ਨਹੀਂ ਸਨ ਪਰੰਤੂ ਅੱਜ ਕੱਲ੍ਹ ਜੋ ਦੇਖਿਆ ਜਾ ਰਿਹਾ ਹੈ ਕਿ ਚੰਗੀ ਤਰ੍ਹਾਂ ਕੰਧ ਕੰਧਾਂ ਨੂੰ ਚਾਰੇ ਪਾਸੋਂ ਪਲੱਸਤਰ ਕਰਕੇ ਪ੍ਰੋਪਰ ਇੱਕ ਤਰ੍ਹਾਂ ਦਾ ਕਹਿ ਦਈਏ ਆਪਾਂ ਪੇਂਟ ਕਰਕੇ ਘਰ ਨੂੰ ਸੁੰਦਰ ਜਿਹੜਾ ਹੈਗੇ ਆ ਉਹ ਬਣਾਇਆ ਜਾ ਰਿਹਾ ਇਹ ਸਾਰੀਆਂ ਡਿਮਾਂਡਾਂ ਅੱਜ ਦੇ ਜਿਹੜੇ ਹੈਗੇ ਦੌਰ 'ਤੇ ਚੱਲ ਰਹੀਆਂ ਨੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਜੋ ਚੇਂਜ ਆਇਆ ਉਹ ਇਹ ਸਾਰਾ ਚੇਂਜ ਆਇਆ ਕਿ ਪਹਿਲਾਂ ਘਰ ਕੱਚੇ ਸੀ ਸਰ ਹੁਣ ਘਰ ਪੱਕੇ ਹੋ ਰਹੇ ਨੇ ਕਲਰ ਹੋ ਰਹੇ ਨੇ ਘਰਾਂ 'ਤੇ